ਰੂਪਨਗਰ ਜ਼ਿਲ੍ਹੇ ਵਿੱਚ ਸਮਾਜ ਭਲਾਈ ਅਤੇ ਵਿਕਾਸ ਪ੍ਰੋਗਰਾਮ ਬਹੁਤ ਸਾਰੇ ਹੈਗੇ ਹਨ ਜਿਨ੍ਹਾਂ ਵਿੱਚੋਂ ਉਹਨਾਂ ਵਿੱਚੋਂ ਮੈਂ ਤੁਹਾਡੇ ਨਾਲ ਕੁਛ ਕੁ ਡਿਸਕਸ ਕਰਨ ਲੱਗਿਆ ਜਿਵੇਂ ਕਿ ਰੋਪੜ ਆਈ ਆਈ ਟੀ ਜਿਹੜੀ ਰੋਪੜ ਆਈ ਆਈ ਟੀ ਹੈ ਇਹਦੇ ਨਾਲ ਸਾਡੇ ਜਿਹੜਾ ਇਲਾਕੇ ਦਾ ਹੈ ਇਹਦੇ ਨਾਲ ਜਿੱਦਾਂ ਹੁਣ ਕਿਤੇ ਵੀ ਕੋਈ ਇੰਸਟੀਚਿਊਟ ਖੁੱਲ੍ਹਦਾ ਹੈਗਾ ਜਿਹੜੀ ਉੱਥੇ ਦੀ ਜਿਹੜੀ ਈਕਨੋਮੀਕ ਉਹ ਹੁੰਦੀ ਹੈਗੀ ਆ ਆਰਥਿਕ ਸਿਸਟਮ ਹੁੰਦਾ ਹੈਗਾ ਹੈ ਉਹ ਸਾਰਾ ਉੱਥੇ ਦੇ ਜਿਹੜੇ ਸਟੂਡੈਂਟ ਹੈ ਜਾਂ ਆਈਲੈਟਸ ਹੈ ਜਾਂ ਕੁਛ ਵੀ ਹੈਗਾ ਉਹਦੇ ਨਾਲ ਸਾਰਾ ਉਹ ਜੁੜਿਆ ਹੁੰਦਾ ਹੈਗਾ ਹੈ ਕਿਉਂਕਿ ਉੱਥੇ ਦੇ ਜਿਹੜੇ ਇੱਥੇ ਜਿੱਦਾਂ ਹੁਣ ਆਈ ਆਈ ਟੀ ਹੈ ਇਹਨਾਂ ਦੇ ਜਿਹੜੇ ਸਟੂਡੈਂਟ ਹੈਗੇ ਹੈ ਇਹਨਾਂ ਨੇ ਕਿਤੇ ਰਹਿਣਾ ਵੀ ਹੈਗਾ ਹੈ ਜੇ ਰਹਿਣਾ ਹੈ ਤਾਂ ਕਿਤੇ ਖਾਣਾ ਵੀ ਹੈਗਾ ਹੈ ਇਹਦੇ ਨਾ ਜਿਹੜੇ ਖਾਣ ਪੀਣ ਨਾਲ ਜਿਹੜੇ ਸਾਰਾ ਕੁਛ ਹੈ ਜਿਹੜੇ ਪੂਰੇ ਇਲਾਕੇ ਦੀ ਇਕੋਨਮੀ ਹੈਗੀ ਹੈ ਉਹ ਸਾਰੀ ਜੁੜੀ ਹੁੰਦੀ ਹੈਗੀ ਹੈ ਇਹਦੇ ਜੁੜਨ ਨਾਲ ਜਿਹੜੀ ਉੱਥੇ ਦੀ ਇਕੋਮਨੀ ਹੈਗੀ ਹੈ ਕਿਸੇ ਵੀ ਹੈਗੀ ਹੈ ਰੀਜਨ ਦੀ ਲੈ ਲਉ ਉਹ ਸਾਰੀ ਉੱਥੇ ਦੀ ਉਹਦੇ ਨਾਲ ਜੁੜੀ ਹੁੰਦੀ ਹੈ ਅਤੇ ਉਹ ਸਾਰੀ ਉੱਥੋਂ ਅਪਗਰੇਡ ਹੁੰਦੀ ਹੈ ਜਾਂ ਉੱਚੀ ਚੱਕ ਹੁੰਦੀ ਹੈ ਉਹਦੇ ਨਾਲ ਉਹਦਾ ਸਾਰਾ ਪੂਰੇ ਇਲਾਕੇ ਦਾ ਉਹਦੇ ਨਾਲ ਵਿਕਾਸ ਹੁੰਦਾ ਹੈਗਾ ਹੈ